ਹਾਂਜੀ ਸਾਨੂੰ ਪਾਣੀ ਦੀ ਸਪਲਾਈ ਮਿਲਦੀ ਹੈ ਟੂਟੀ ਦਾ ਪਾਣੀ ਜੇਕਰ ਪੀਣ ਯੋਗ ਹੋਵੇ ਤਾਂ ਸਾਡਾ ਜੀਵਨ ਵਧੀਆ ਹੋਵੇਗਾ ਕਿਉਂਕਿ ਪਾਣੀ ਮਨੁੱਖ ਦੇ ਜੀਵਨ ਦਾ ਮੂਲ ਤੱਤ ਹੈ ਇਸ ਦੇ ਬਿਨਾ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਟੂਟੀ ਦਾ ਪਾਣੀ ਮਿਲਣ ਨਾਲ ਅਸੀਂ ਆਪਣੇ ਸਾਰੇ ਕੰਮ ਜਿਵੇਂ ਖਾਣਾ ਪਕਾਉਣਾ ਸਫਾਈ ਕਰਨਾ ਆਦਿ ਕਰ ਸਕਦੇ ਹਾਂ ਹਾਂਜੀ ਸਾਡੇ ਘਰ ਆਉਣ ਵਾਲੀ ਪਾਣੀ ਦੀ ਸਪਲਾਈ ਸਾਫ ਹੈ ਇਸ ਪ੍ਰਕਾਰ ਸਾਨੂੰ ਵਧੀਆ ਪਾਣੀ ਮਿਲਦਾ ਹੈ